ਜਾਨਵਰ ਦੀ ਉਤਪਾਦਕ ਪ੍ਰਕਿਰਿਆ ਘਰ ਨੂੰ ਲੈ ਕੇ ਹਹ ਜਿਹੜਾ ਵੀ ਕੋਈ ਜਾਨਵਰ ਨੂੰ ਆਪਾਂ ਪਾਲਦੇ ਹਾਂ ਉਸ ਤੋਂ ਇਨਕਮ ਕਿਵੇਂ ਅਗਾਂਹ ਕਰਦੇ ਹਾਂ ਹੈ ਨਾ ਮੰਨ ਲਓ ਕੋਈ ਜਿਵੇਂ ਇੱਕ ਮੁਰਗੀ ਹੈ ਆਪਾਂ ਮੁਰਗੀ ਨੂੰ ਘਰ ਦੇ ਵਿੱਚ ਰੱਖਦੇ ਹਾਂ ਹੈ ਨਾ ਅਤੇ ਜਾਣੀ ਕਿ ਜੋੜਾ ਮੁਰਗਾ ਅਤੇ ਮੁਰਗੀ ਜਿਹੜਾ ਆਪਾਂ ਲਿਆ ਕਿਸੇ ਤੋਂ ਉਸ ਤੋਂ ਬਾਅਦ ਮੁਰਗੀ ਨੂੰ ਘਰ ਦੇ ਵਿੱਚ ਰੱਖ ਕੇ ਉਹ ਉਸ ਤੋਂ ਗਾਹਾਂ ਵੀ ਆਂਡੇ ਲੈਂਦੇ ਹਾਂ ਆਂਡਿਆਂ ਨੂੰ ਇਕੱਠੇ ਕਰਕੇ ਉਸ ਤੋਂ ਬਾਅਦ ਆਪਾਂ ਇੱਕ ਮੁਰਗੀ ਦੇ ਬੱਚੇ ਕਢਵਾਉਂਦੇ ਹਾਂ ਜਾਣੀ ਕਿ ਬਾਰ੍ਹਾਂ ਆਂਡੇ ਬਾਰ੍ਹਾਂ ਬੱਚੇ ਕਢਵਾ ਲਏ ਤਾਂ ਉਹ ਬਾਰ੍ਹਾਂ ਬੱਚਿਆਂ ਨੂੰ ਜਾਂ ਬਾਰ੍ਹਾਂ ਲਾ ਲਓ ਜਾਂ ਉਸ ਤੋਂ ਵੱਧ ਲਾ ਲਓ ਹੈ ਨਾ ਉਹ ਬਾਰ੍ਹਾਂ ਬੱਚੇ ਜਦੋਂ ਪੈਦਾ ਹੁੰਦੇ ਨੇ ਪੈਦਾ ਹੋਣ ਤੋਂ ਬਾਅਦ ਆਪਾਂ ਉਹਨੂੰ ਫੀਡ ਵਗੈਰਾ ਦੇ ਕੇ ਪ੍ਰੋਪਰ ਤੌਰ 'ਤੇ ਜੋ ਕਿ ਬੱਚਿਆਂ ਦੀ ਜਾਨਵਰਾਂ ਦੀ ਫੀਡ ਹੁੰਦੀ ਹੈ ਮੁਰਗੀਆਂ ਦੀ ਹੈ ਨਾ ਬੱਚਿਆਂ ਦੀ ਚੂਚਿਆਂ ਦੀ ਉਹ ਫੀਡ ਦੇ ਕੇ ਆਪਾਂ ਬੱਚਿਆਂ ਨੂੰ ਵੱਡਾ ਕਰ ਲਿਆ ਪਾਲ ਲਿਆ ਯਾਨੀ ਕਿ ਮੰਨ ਲਓ ਵੀ ਢਾਈ ਮਹੀਨਿਆਂ ਦੇ ਵਿੱਚ ਬੱਚੇ ਤਿਆਰ ਹੁੰਦੇ ਨੇਗੇ ਤਾਂ ਉਸ ਤੋਂ ਬਾਅਦ ਆਪਾਂ ਉਹਨੂੰ ਵੇਚਣਾ ਕਿਵੇਂ ਹੈ ਵੇਚਣਾ ਇਹ ਹੈ ਵੀ ਐਂਡ ਤੱਕ ਵੀ ਇੱਕ ਤਾਂ ਘਰ ਰੱਖਣ ਤੀਕਰ ਜਿਹੜੇ ਹੁੰਦੇ ਨੇ ਇਕੱਲੇ ਆਂਡੇ ਹੀ ਉਹਨਾਂ ਬੱਚਿਆਂ ਤੋਂ ਲੈਣੇ ਹੁੰਦੇ ਹੈਗੇ ਜਦੋਂ ਵੱਡੇ ਹੋ ਜਾਂਦੇ ਹੈਗੇ ਤਾਂ ਇੱਕ ਹੁੰਦਾ ਵੀ ਕਸਾਈ ਨੂੰ ਦੇਣਾ ਮੰਨ ਲਓ ਆਪਾਂ ਕਿਸੇ ਕਸਾਈ ਨੂੰ ਦਿੰਦੇ ਤਾਂ ਕਸਾਈ ਉਸ ਨੂੰ ਵੱਢ ਕੇ ਕਿੱਲੋਆਂ ਦੇ ਹਿਸਾਬ ਨਾਲ ਜਿਹੜਾ ਕਿ ਵੇਚਦਾ ਮੰਨ ਲਓ ਵੀ ਦੋ ਸੌ ਰੁਪਈਏ ਕਿੱਲੋ ਵੇਚਤਾ ਜਾਂ ਤਿੰਨ ਸੌ ਰੁਪਈਏ ਕਿੱਲੋ ਵੇਚਤਾ ਤਾਂ ਉਸਨੂੰ ਸਾਰਿਆਂ ਤੋਂ ਪਹਿਲਾਂ ਜਾਣ ਵੱਢਣ ਵਾਲਾ ਜਾਣੀ ਕਿ ਤੇਰ੍ਹਾਂ ਦੇ ਤੇਰ੍ਹਾਂ ਬੱਚੇ ਕਸਾਈ ਕੋਈ ਲੈ ਗਿਆ ਤਾਂ ਉਸ ਨੂੰ ਛਿੱਲ ਕੇ ਖੰਭ ਲਾਹ ਕੇ ਸਾਫ ਕਰਕੇ ਮੀਟ ਜਿਹੜਾ ਕਿ ਦੋ ਸੌ ਰੁਪਈਏ ਦੇ ਹਿਸਾਬ ਨਾਲ ਕਿੱਲੋ ਦੇ ਨਾਲ ਅਗਾਂਹ ਵੇਚਦਾ ਗਾ ਇਸ ਤਰ੍ਹਾਂ ਹੀ ਜਾਨਵਰਾਂ ਦੇ ਉਤਪਾਦ ਦੀ ਪ੍ਰਕਿਰਿਆ ਜਾਣੀ ਕਿ ਇਹ ਆਮ ਤਰੀਕੇ ਨੇਗੇ ਅਤੇ ਅਗਾਂਹ ਇਸਨੂੰ ਵੇਚਣ ਤੱਕ ਇਸ ਤਰ੍ਹਾਂ ਹੀ ਪੈਸੇ ਉਹ ਕਮਾਉਂਦੇ ਨੇ ਪਹਿਲਾਂ ਪਾਲਦੇ ਨੇ ਪਾਲ ਕੇ ਫਿਰ ਉਹਨੂੰ ਅਗਾਂਹ ਵੇਚਦੇ ਨੇ ਵੇਚਦੇ ਵੀ ਅਗਾਂਹ ਕਸਾਈਆਂ ਨੂੰ ਅਤੇ ਕਸਾਈ ਅਗਾਂਹ ਕਿੱਲੋਆਂ ਦੇ ਹਿਸਾਬ ਨਾਲ ਵੇਚਦਾ ਹੈਗਾ